ਸਾਲ ਦੋ ਹਜ਼ਾਰ ਉੱਨੀ ਦੇ ਵਿੱਚ ਯੂ ਜੀ ਸੀ ਨੈੱਟ ਦੀ ਪ੍ਰੀਖਿਆ ਪਾਸ ਕਰਨ ਦੇ ਲਈ ਮੈਂ ਤਿਆਰੀ ਕਰਨੀ ਸੀ ਇਸ ਲਈ ਮੈਨੂੰ ਕਈ ਸਾਰੀਆਂ ਕਿਤਾਬਾਂ ਦੀ ਜ਼ਰੂਰਤ ਸੀ ਜਿਵੇਂ ਕਿ ਹਿੰਦੀ ਸਾਹਿਤ ਦਾ ਇਤਿਹਾਸ ਅਚਾਰੀਆ ਰਾਮ ਚੰਦਰ ਸ਼ੁਕਲ ਜੀ ਦੁਆਰਾ ਲਿਖਿਆ ਗਿਆ ਹੈ ਹਿੰਦੀ ਸਾਹਿਤ ਦਾ ਇਤਿਹਾਸ ਡਾਕਟਰ ਨਗਿੰਦਰ ਦੁਆਰਾ ਤਾਂ ਮੈਂ ਇਹ ਦੋਨੋਂ ਕਿਤਾਬਾਂ ਨੂੰ ਐਮਾਜੋਨ 'ਤੇ ਲੱਭਿਆ ਉਸ 'ਤੇ ਦੇਖਣ ਤੋਂ ਬਾਅਦ ਮੈਂ ਔਨਲਾਈਨ ਪੇਮੈਂਟ ਕੀਤੀ ਅਤੇ ਇਸ ਤੋਂ ਮਗਰੋਂ ਇਹ ਕਿਤਾਬਾਂ ਲਗਭਗ ਇੱਕ ਹਫ਼ਤੇ ਮਗਰੋਂ ਮੈਨੂੰ ਪ੍ਰਾਪਤ ਹੋਈਆਂ ਮੇਰਾ ਇੱਕ ਬਹੁਤ ਹੀ ਵਧੀਆ ਅਨੁਭਵ ਰਿਹਾ ਅਤੇ ਮੈਨੂੰ ਇਹ ਕਿਤਾਬਾਂ ਬੜੀ ਹੀ ਦਰੁਸਤ ਠੀਕ ਹਾਲਤ ਦੇ ਵਿੱਚ ਪ੍ਰਾਪਤ ਹੋਈਆਂ ਅਤੇ ਜਿਨ੍ਹਾਂ ਨੇ ਮੇਰੀ ਪ੍ਰੀਖਿਆ ਨੂੰ ਪਾਸ ਕਰਨ ਦੇ ਲਈ ਮੇਰੀ ਬਹੁਤ ਮਦਦ ਕੀਤੀ ਅਤੇ ਉਹ ਕਿਤਾਬਾਂ ਨਾ ਕੇਵਲ ਮੇਰੀ ਯੂ ਜੀ ਸੀ ਨੈੱਟ ਦੀ ਪ੍ਰੀਖਿਆ ਲਈ ਸਨ ਅਸਲ ਵਿੱਚ ਉਹ ਕਿਤਾਬਾਂ ਅੱਜ ਵੀ ਮੇਰੀ ਸ਼ੋਅ ਦੇ ਵਿੱਚ ਮੇਰੇ ਕੰਮ ਆ ਰਹੀਆਂ ਹਨ ਅਤੇ ਉਹਨਾਂ ਕਿਤਾਬਾਂ ਤੋਂ ਮੈਨੂੰ ਬਹੁਤ ਸਿੱਖਣ ਨੂੰ ਮਿਲਿਆ ਅਤੇ ਜੇਕਰ ਮੇਰੇ ਤੋਂ ਕੋਈ ਅੱਗੇ ਵੀ ਸਲਾਹ ਲੈਂਦਾ ਹੈ ਤਾਂ ਮੈਂ ਉਹ ਕਿਤਾਬਾਂ ਅੱਗੇ ਫਲਿਪਕਾਰਟ ਐਮਾਜ਼ੋਨ ਦਾ ਰੈਫਰੈਂਸ ਦੇ ਕੇ ਪ੍ਰੈਫਰ ਕਰਦੀ ਹਾਂ